ਵੱਖ ਵੱਖ ਪਕਵਾਨਾਂ ਨੂੰ ਪਕਾਉਣ 'ਚ ਬਹੁਤ ਹੀ ਮਜ਼ਾ ਆਉਂਦਾ ਹੈ ਜਿਵੇਂ ਕਿ ਇਟੈਲੀਅਨ ਚਾਈਨੀਜ਼ ਜੋ ਕਿ ਬੱਚੇ ਖੁਸ਼ ਹੋ ਕੇ ਖਾਂਦੇ ਨੇ ਅਤੇ ਉਹਨਾਂ ਨੂੰ ਖੁਸ਼ ਹੋ ਕੇ ਖਾਂਦਾ ਹੋਇਆ ਦੇਖਦਿਆਂ ਹੋਏ ਮੈਨੂੰ ਵੀ ਬਹੁਤ ਆਨੰਦ ਆਉਂਦਾ ਹੈ ਮੈਨੂੰ ਵੱਖ ਵੱਖ ਸ਼ਹਿਵਾਂ ਮਤਲਬ ਕੋਜ਼ੀਨ ਬਣਾਉਣ ਦਾ ਬਹੁਤ ਹੀ ਸ਼ੌਂਕ ਹੈ ਤੁਸੀਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਇੱਕ ਦੋ ਚੀਜ਼ਾਂ ਨਾਲ ਵੀ ਬਹੁਤ ਕੁਛ ਵੱਖਰਾ ਵੱਖਰਾ ਬਣਾ ਸਕਦੇ ਹੋ ਅਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਇਹ ਰੁਚੀ ਮੇਰੇ ਅੰਦਰ ਕਰੋਨਾ ਵਿੱਚ ਪੈਦਾ ਹੋਈ ਕਿਉਂਕਿ ਕਰੋਨਾ ਵਿੱਚ ਸਾਡੇ ਕੋਲ ਬਾਹਰ ਦਾ ਖਾਣ ਦਾ ਓਪਸ਼ਨ ਬੰਦ ਸੀ ਅਤੇ ਨਾ ਹੀ ਬਾਹਰ ਦਾ ਕੁਛ ਮਿਲਦਾ ਸੀ ਕੁਛ ਵੀ ਉਦੋਂ ਸਭ ਕੁਛ ਬੰਦ ਸੀਗਾ ਤਾਂ ਜੋ ਮੈਨੂੰ ਘਰ ਹੀ ਬਣਾਉਣ ਦੀ ਆਦਤ ਪੈ ਗਈ ਤੁਸੀਂ ਬ੍ਰੈੱਡ ਦੇ ਨਾਲ ਗੁਲਾਬ ਜਾਮੁਨ ਬਣਾ ਸਕਦੇ ਹੋ ਨਾਚੋਜ ਨਾਚੋਜ ਜਿਵੇਂ ਕਿ ਚਿਪਸ ਬਾਹਰੋਂ ਮਿਲਦੇ ਹਨ ਜਿਸ ਦੇ ਉੱਤੇ ਤੁਸੀਂ ਥੋੜ੍ਹੀ ਜਿਹੀ ਮਿਊਨੀਜ ਜਾਂ ਕੈਚੱਪ ਪਾ ਕੇ ਤੇ ਨਾਲ ਪਿਆਜ਼ ਟਮਾਟਰ ਪਾ ਕੇ ਬਹੁਤ ਵਧੀਆ ਬੱਚਿਆਂ ਨੂੰ ਸਨੈਕਸ ਤਿਆਰ ਕਰਕੇ ਦੇ ਸਕਦੇ ਹੋ ਪੀਜ਼ਾ ਪੀਜ਼ਾ ਬਾਹਰ ਬੱਚੇ ਜਦੋਂ ਖਾਂਦੇ ਹਨ ਉਹ ਅਨਹੈਲਥੀ ਹੁੰਦਾ ਹੈ ਜੋ ਕਿ ਚੰਗਾ ਨਹੀਂ ਆ ਸਿਹਤ ਲਈ ਉਸ ਨੂੰ ਤੁਸੀਂ ਘਰ ਬੜੇ ਵਧੀਆ ਢੰਗ ਨਾਲ ਸੂਜੀ ਦਾ ਪੀਜ਼ਾ ਰਾਈ ਰਾਗੀ ਦਾ ਪੀਜ਼ਾ ਬਣਾ ਕੇ ਦੇ ਸਕਦੇ ਹੋ ਅਤੇ ਜੋ ਘਰ ਵੀ ਜੋ ਲੋਕ ਆ ਜਾਣ ਗੈਸਟ ਵਾਸਤੇ ਵੀ ਤੁਸੀਂ ਇਸ ਤਰ੍ਹਾਂ ਦੇ ਹੀ ਛੋਟੇ ਛੋਟੇ ਸਨੈਕਸ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਇਸ ਨਾਲ ਤੁਹਾਡਾ ਹੱਥ ਵੀ ਖੁੱਲ੍ਹਦਾ ਹੈ ਅਤੇ ਪੈਸੇ ਵੀ ਬਚਦੇ ਹਨ ਬਾਹਰ ਦਾ ਸਮਾਨ ਇੱਕ ਤਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਦੂਜਾ ਸਾਡੀ ਜੇਬ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਧੰਨਵਾਦ